ਮੇਰੇ ਅਕੋਰਡਿੰਗ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਇਤਿਹਾਸ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਤਿਹਾਸ ਤੋਂ ਸਾਡੇ ਪਿਛੋਕੜ ਦੇ ਬਾਰੇ ਪਤਾ ਲੱਗਦਾ ਹੈ ਕਿ ਸਾਡੀ ਉਤਪਤੀ ਕਿੱਥੇ ਤੋਂ ਹੋਈ ਹੈ ਕਿ ਜਿਵੇਂ ਕਿ ਇਤਿਹਾਸ ਦਾ ਸਭ ਤੋਂ ਮੇਨ ਮੁੱਖ ਭਾਗ ਹੈ ਆਜ਼ਾਦੀ ਆਜ਼ਾਦੀ ਦੇ ਬਾਰੇ ਸਾਡੇ ਜਨਰੇਸ਼ਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਸਾਨੂੰ ਸਾਡੇ ਅ ਸ਼ਹੀਦਾਂ ਨੇ ਤੇ ਕਿ ਕਿਵੇਂ ਆਜ਼ਾਦੀ ਦਿਵਾਈ ਆਪਣਾ ਬਲੀਦਾਨ ਦੇ ਕੇ ਅਤੇ ਸਾਡੇ ਪੰਜਾਬ ਵਿੱਚ ਕਾਫੀ ਮਹਾਨ ਸ਼ਖਸ਼ੀਅਤ ਹੋਏ ਹਨ ਜਿਹਨਾਂ ਨੇ ਜਿਹਨਾਂ ਦਾ ਆਜ਼ਾਦੀ ਵਿੱਚ ਮੁੱਖ ਰੋਲ ਸੀ ਜਿਵੇਂ ਸ਼ਹੀਦ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਕਰਤਾਰ ਸਿੰਘ ਸਰਾਭਾ ਜੀ ਲਾਲਾ ਲਾਜਪਤ ਰਾਏ ਜੀ ਲਾਲਾ ਲਾਜਪਤ ਰਾਏ ਜੀ ਦਾ ਪੰਜਾਬ ਦੀ ਆਜ਼ਾਦੀ ਵਿੱਚ ਕਾਫੀ ਇੱਕ ਮਹੱਤਵਪੂਰਨ ਹਿੱਸਾ ਸੀ